ਟੁੱਟੇ ਤਾਰੇ ਨਾਲ ਕੁਝ ਮੇਰੇ ਬਚਪਨ ਦੀਆਂ ਯਾਦਾਂ ਜੁੜੀਆਂ ਨੇ ਕਿ ਜਦੋਂ ਤਾਰਾ ਟੁੱਟਿਆ ਅਤੇ ਮੈਂ ਉਸ ਸਮੇਂ ਮੇਰੇ ਤਾਏ ਕੇ ਘਰ ਵੱਲ ਬਾਹਰ ਹੀ ਪਏ ਹੋਏ ਸੀ ਅਤੇ ਮੈਂ ਮੰਮੀ ਡੈਡੀ ਨੂੰ ਆਪਣੇ ਨੂੰ ਦੱਸਿਆ ਅਤੇ ਵੀ ਨੇ ਮੰਮੀ ਇਸ ਤਰ੍ਹਾਂ ਵੀ ਤਾਰਾ ਟੁੱਟਿਆ ਉਹ ਕਹਿੰਦੇ ਵੀ ਪੁੱਤ ਵੀ ਓਦੋਂ ਨਾ ਟੁੱਟੇ ਤਾਰੇ ਤੋਂ ਕੋਈ ਵਿਸ਼ ਮੰਗ ਸਕਦੇ ਹੋ ਬੱਚੇ ਅਤੇ ਉਹਨਾਂ ਨੇ ਇੱਦਾਂ ਆਖਿਆ ਮੈਨੂੰ ਪਿਆਰ ਨਾਲ ਅਤੇ ਜਦੋਂ ਮੈਂ ਉਦੋਂ ਕੁਝ ਮੰਗਿਆ ਨਹੀਂ ਜਦੋਂ ਬਾਅਦ 'ਚ ਮੈਂ ਵੱਡਾ ਹੋ ਗਿਆ ਫਿਰ ਮੈਂ ਇੱਕ ਦਿਨ ਬਾਹਰ ਪਏ 'ਤੇ ਫਿਰ ਮੈਂ ਉਸ ਤੋਂ ਵਿਸ਼ ਮੰਗੀ ਆਪਣੇ ਪਰਮਾ ਆ ਆਪਣੇ ਮਾਂ ਪਿਓ ਦੀ ਤਨ ਦੀ ਤੰਦਰੁਸਤੀ ਲਈ ਸਾਰੇ ਪਰਿਵਾਰ ਲਈ ਅਤੇ ਪਰ ਮਹਾਰਾਜ ਦੀ ਬੜੀ ਕਿਰਪਾ ਠੀਕ ਠਾਕ ਹੈ ਜੀ ਸਤਿ ਸ਼੍ਰੀ ਅਕਾਲ ਜੀ ਧੰਨਵਾਦ ਜੀ